ਮੈਂ ਯੋਗਾ ਦੀ ਕਲਾਸ ਬੜੇ ਚਾਅ ਨਾਲ ਸ਼ੁਰੂ ਕੀਤੀ ਸੀ ਇੰਨਾ ਕੁਛ ਯੋਗਾ ਬਾਰੇ ਵਧੀਆ ਸੁਣ ਲਿਆ ਸੀ ਕੀ ਦਿਲ ਕਰਦਾ ਸੀ ਕਿ ਫਟਾਫਟ ਕਿਸੇ ਨਾ ਕਿਸੇ ਤਰੀਕੇ ਮੈਂ ਯੋਗਾ ਸਿੱਖਣਾ ਸ਼ੁਰੂ ਕਰ ਦੇਵਾਂ ਫਿਰ ਸਾਡੀ ਕਲਾਸ ਸ਼ੁਰੂ ਹੁੰਦੀ ਹੈ ਸਾਡੇ ਯੋਗਾ ਦੇ ਟੀਚਰ ਸਾਡੇ ਸਾਹਮਣੇ ਆਉਂਦੇ ਹਨ ਉਹ ਇੰਨੇ ਫਿਟ ਹਨ ਖੁਸ਼ ਹਨ ਖੁਸ਼ੀ ਉਹਨਾਂ ਚ' ਉਹਨਾਂ ਦੇ ਚਿਹਰੇ 'ਤੇ ਝਲਕਦੀ ਹੈ ਉਹ ਸਾਨੂੰ ਪਹਿਲੇ ਦਿਨ ਯੋਗਾ ਦੇ ਕੁਝ ਆਸਾਨ ਸਾਧਨ ਜਾਂ ਆਸਾਨ ਯੋਗ ਜੋ ਹੈ ਸਿਖਾਉਂਦੇ ਹਨ ਉਹ ਸਿੱਖਣਾ ਉਹਨਾਂ ਨੂੰ ਕਰਨਾ ਬਹੁਤ ਅੱਛਾ ਲੱਗ ਰਿਹਾ ਸੀ ਹੌਲੀ ਹੌਲੀ ਸਰੀਰ ਇੱਕ ਲੈਅ ਦੇ ਵਿੱਚ ਇੱਕ ਤਸੱਲੀ ਦੇ ਵਿੱਚ ਜਾ ਰਿਹਾ ਸੀ ਕਿ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਕਿ ਅਸੀਂ ਕੁਛ ਬਹੁਤ ਵਧੀਆ ਕੁਛ ਬਹੁਤ ਅੱਛਾ ਸਿੱਖ ਰਹੇ ਹਾਂ ਉਹਨਾਂ ਨੇ ਸਾਨੂੰ ਸੋਖੇ ਜਿਹੇ ਯੋਗਾ ਦੇ ਸਾਧਨ ਦੱਸੇ ਪਰ ਫਿਰ ਵੀ ਉਹਨਾਂ ਨੂੰ ਕਰਕੇ ਬਹੁਤ ਵਧੀਆ ਲੱਗਾ ਔਰ ਜਦੋਂ ਮੈਂ ਆਪਣੀ ਕਲਾਸ ਲਗਾ ਕੇ ਬਾਹਰ ਨਿਕਲੀ ਔਰ ਪਹਿਲੇ ਦਿਨ ਆਪਣੇ ਸਰੀਰ ਦੇ ਅੰਦਰ ਜੋ ਮੈਂ ਮਹਿਸੂਸ ਕੀਤਾ ਜੋ ਮੈਂ ਚੇਂਜ ਮਹਿਸੂਸ ਕੀਤੀ ਉਸ ਦੇ ਨਾਲ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਮੇਰਾ ਸਰੀਰ ਬਹੁਤ ਹਲਕਾ ਫੁਲਕਾ ਹੋ ਚੁੱਕਾ ਹੈ ਇਸ ਦੇ ਅੰਦਰ ਇੱਕ ਬਹੁਤ ਜੋ ਭਾਰੀ ਚੀਜ਼ ਸੀ ਜੋ ਇਹੋ ਜਿਹੀ ਚੀਜ਼ ਸੀ ਜੋ ਨਹੀਂ ਹੋਣੀ ਚਾਹੀਦੀ ਉਹ ਨਿਕਲ ਚੁੱਕੀ ਸੀ